ਹੈਲੋ ਹਾਂਜੀ ਮੈਂ ਸ਼ਵੇਤਾ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਥੋੜ੍ਹੀ ਦੇਰ ਪਹਿਲਾਂ ਨਾ ਚੰਡੀਗੜ੍ਹ ਏਅਰਪੋਰਟ ਤੋਂ ਲੈ ਕੇ ਬੱਸ ਸਟੈਂਡ ਤੱਕ ਦੀ ਕੈਬ ਬੁੱਕ ਕੀਤੀ ਸੀਗੀ ਜੀ ਐਕਚੁਲੀ ਮੈਂ ਕੈਬ ਇੱਕ ਵਾਰੀ ਬੁੱਕ ਕਰ ਲਿਤੀ ਸੀ ਕਿਉਂਕਿ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਸੀ ਮੈਂ ਪਹਿਲਾਂ ਉਹਨੂੰ ਫੋਨ ਕੀਤਾ ਸੀ ਮੈਂ ਉਹਨੂੰ ਕਿਹਾ ਸੀ ਕਿ ਉਹ ਮੈਨੂੰ ਆ ਕੇ ਲੈ ਜਾਵੇ ਪਹਿਲਾਂ ਉਹ ਕਹਿੰਦਾ ਕਿ ਮੈਂ ਨਹੀਂ ਲੈ ਕੇ ਜਾ ਸਕਦਾ ਤੈਨੂੰ ਇਸ ਕਰਕੇ ਮੈਂ ਚੰਡੀਗੜ੍ਹ ਏਅਰਪੋਰਟ ਤੋਂ ਲੈ ਕੇ ਚੰਡੀਗੜ੍ਹ ਬੱਸ ਸਟੈਂਡ ਤੱਕ ਜਿਹੜੀ ਸੀਗੀ ਤੁਹਾਡੀ ਕੈਬ ਬੁੱਕ ਕਰ ਲਿੱਤੀ ਸੀਗੀ ਸਰ ਔਰ ਉਸ ਚੀਜ਼ ਦਾ ਮੈਂ ਆਪਣੀ ਪੇਮੈਂਟ ਵੀ ਕਰਤੀ ਸੀ ਤੁਹਾਨੂੰ ਤੁਹਾਡੇ ਨੰਬਰ 'ਤੇ ਪੇਮੈਂਟ ਕਰਤੀ ਸੀ ਜੋ ਵੀ ਮੈਨੂੰ ਪੇਮੈਂਟ ਮੋਡ ਮਿਲਿਆ ਸੀ ਮੈਂ ਗੂਗਲ ਪੇ ਦੇ ਉੱਤੋਂ ਗੂਗਲ ਪੇ ਦੇ ਨਾਲ ਤੁਹਾਨੂੰ ਪੇਮੈਂਟ ਪਹਿਲਾਂ ਹੀ ਐਡਵਾਂਸ ਦੇ ਵਿੱਚ ਕਰ ਦਿੱਤੀ ਸੀ ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਮੇਰੇ ਬ੍ਰਦਰ ਦਾ ਮੈਨੂੰ ਦੁਬਾਰਾ ਫੋਨ ਆਇਆ ਔਰ ਉਹ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਲੈਣ ਆ ਜਾਂਦਾ ਤੂੰ ਕੈਬ ਜਿਹੜੀ ਹੈ ਉਹ ਕੈਂਸਲ ਕਰਵਾ ਦੇ ਤਾਂ ਇਸ ਕਰਕੇ ਜੀ ਮੈਨੂੰ ਕੈਬ ਜਿਹੜੀ ਹੈ ਉਹ ਕੈਂਸਲ ਕਰਵਾਉਣੀ ਪਈ ਮੈਨੂੰ ਰੱਦ ਕਰਵਾਉਣਾ ਪਿਆ ਜੋ ਮੈਂ ਤੁਹਾਡੀ ਬੁਕਿੰਗ ਕੀਤੀ ਸੀ ਮੈਂ ਇਸ ਚੀਜ਼ ਲਈ ਮੁਆਫੀ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਇਨਕਨਵੀਨੀਅਸ ਦਿੱਤੀ ਪਰ ਕੀ ਤੁਸੀਂ ਮੇਰੇ ਜਿਹੜੇ ਓਲਾ ਵ ਵਾਲੇਟ ਹੈ ਉਬਰ ਵਾਲੇਟ ਹੈ ਉਹਦੇ ਵਿੱਚ ਤੁਸੀਂ ਰਿਫੰਡ ਟਰਾਂਸਫਰ ਕਰ ਸਕਦੇ ਹੋ ਚਾਹੇ ਤੁਸੀਂ ਆਪਣੇ ਜਿਹੜੇ ਇਨਕਨਵੀਨੀਅਸ ਦੇ ਚਾਰਜਿਜ਼ ਨੇ ਉਹ ਤੁਸੀਂ ਕੱਟ ਸਕਦੇ ਹੋ ਪੰਜ ਪਰਸੈਂਟ ਦਸ ਪਰਸੈਂਟ ਜਿੰਨੇ ਵੀ ਤੁਸੀਂ ਕੱਟਣੇ ਹੈ ਬਟ ਕਿਰਪਾ ਕਰਕੇ ਬਾਕੀ ਦਾ ਰਿਫੰਡ ਜਿਹੜਾ ਤੁਸੀਂ ਮੇਰੇ ਉਹ ਉਭਰ ਵਾਲਿਟ ਦੇ ਵਿੱਚ ਟ੍ਰਾਂਸਫਰ ਕਰ ਦਿਓ ਜੀ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਮੈਂ ਅੱਗੇ ਤੋਂ ਇੱਦਾਂ ਦਾ ਕੁਛ ਵੀ ਨਹੀਂ ਕਰਾਂਗੀ ਮੈਂ ਧਿਆਨ ਰੱਖਾਂਗੀ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਨਕਨਵੀਨੀਅਸ ਨਾ ਹੋਵੇ ਅਗਰ ਮੈਂ ਕੈਬ ਬੁੱਕ ਕਰਵਾਈ ਹੈ ਤਾਂ ਮੈਂ ਉਹ ਜਿਹੜੀ ਜਰਨੀ ਆ ਉਹ ਪੂਰੀ ਕਰਾਂ ਪਰ ਅੱਜ ਮੇਰੀ ਕੋਈ ਮਜਬੂਰੀ ਸੀ ਇਸ ਕਰਕੇ ਮੈਨੂੰ ਇੱਦਾਂ ਕਰਨਾ ਪਿਆ ਤਾਂ ਕਿਰਪਾ ਕਰਕੇ ਜੀ ਮੇਰਾ ਰਿਫੰਡ ਜਿਹੜਾ ਹੈ ਤੁਸੀਂ ਮੇਰੇ ਵਾਲਿਟ ਦੇ ਵਿੱਚ ਵਾਪਸ ਕਰ ਦਿਓ ਚਾਹੇ ਉਹਦੇ ਵਿੱਚੋਂ ਤੁਸੀਂ ਆਪਣੀ ਚਾਰਜਸ ਜਿਹੜੇ ਆ ਪੰਜ ਦਸ ਪਰਸੈਂਟ ਜਿੰਨੇ ਵੀ ਕੱਟਣੇ ਆ ਉਹ ਕੱਟ ਕੇ ਵਾਪਸ ਕਰ ਦਿਓ ਧੰਨਵਾਦ ਜੀ